ਕੱਲ ਬਿੱਲ ਭਰਨ ਦੀ ਤਰੀਕ ਆਖਰੀ ਤਰੀਕ ਸੀ ਅਤੇ ਮੈਂ ਸੋਚਿਆ ਕਿ ਅੱਜ ਮੈਂ ਬਿੱਲ ਭਰ ਦੇਵਾਂ ਜਿਸ ਵਿੱਚ ਮੇਰੇ ਘਰ ਦਾ ਬਿੱਲ ਪਚਾਨਵੇਂ ਸੌ ਰੁਪਇਆ ਆਇਆ ਹੋਇਆ ਸੀ ਅਤੇ ਮੈਂ ਜਦੋਂ ਉਸਨੂੰ ਆਨਲਾਈਨ ਭਰਿਆ ਤਾਂ ਮੇਰੇ ਬੈਂਕ 'ਚੋਂ ਦਸ ਹਜ਼ਾਰ ਰੁਪਇਆ ਕੱਟਿਆ ਗਿਆ ਮੈਂ ਇਸ ਪਤਾ ਕਰਵਾਉਣਾ ਚਾਹੁੰਦੀ ਹਾਂ ਕਿ ਪੰਜ ਸੌ ਰੁਪਏ ਦਾ ਅੰਤਰ ਕਿਵੇਂ ਆ ਗਿਆ ਕ੍ਰਿਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਮੇਰਾ ਪੰਜ ਸੌ ਰੁਪਏ ਕਿਵੇਂ ਕੱਟਿਆ ਗਿਆ ਮੈਨੂੰ ਪੈਸੇ ਦੀ ਬਹੁਤ ਲੋੜ ਐ ਤਾਂ ਕ੍ਰਿਪਾ ਕਰਕੇ ਇਹ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਮੈਂ ਬਿਜਲੀ ਬੋਰਡ ਵਿੱਚ ਵੀ ਇਸ ਦੀ ਜਾਂਚ ਕਰਵਾਵਾਂਗੀ ਅਤੇ ਤੁਸੀਂ ਵੀ ਤੁਸੀਂ ਵੀ ਮੈਨੇਜਰ ਨਾਲ ਗੱਲ ਕਰਕੇ ਇਸ ਦੀ ਜਾਂਚ ਕਰਵਾਉ ਧੰਨਵਾਦ